ਭੰਗੜੇ ਦੇ ਕੁਝ ਆਮ ਸਟੈਪ ਜਿਵੇਂ ਕਿ ਲਹਿਰੀਆ ਲੁੱਡੀ ਝੁੰਮਰ ਮੜਕ ਆਦਿ ਹਨ ਜੋ ਸੱਭਿਆਚਾਰ ਦੇ ਜ਼ੋਰਦਾਰ ਜਸ਼ਨ ਸੁਭਾਅ ਵਾਲੇ ਹਨ ਅਤੇ ਇਹ ਕਿਸੇ ਵੀ ਖੁਸ਼ੀ ਨੂੰ ਦੂਣਾ ਕਰਨ 'ਤੇ ਭੰਗੜੇ ਵਿੱਚ ਉਤਸ਼ਾਹ ਭਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦਾ ਹੈ